ਮੈਨੂੰ ਖਾਣਾ ਬਣਾਉਣ ਦਾ ਬਹੁਤ ਹੀ ਸ਼ੌਕ ਹੈ ਅਤੇ ਮੈਂ ਸਮੇਂ ਸਮੇਂ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਵਿਅੰਜਨ ਬਣਾ ਕੇ ਆਪਣੀਆਂ ਸਹੇਲੀਆਂ ਦੋਸਤਾਂ ਰਿਸ਼ਤੇਦਾਰਾਂ ਨੂੰ ਖਿਲਾਉਂਦੀ ਰਹਿੰਦੀ ਹਾਂ ਇੱਕ ਵਾਰ ਸਾਡੇ ਖੇਤਰ ਵਿੱਚ ਖਾਣਾ ਬਣਾਉਣ ਦਾ ਮੁਕਾਬਲਾ ਸੀ ਜਿਸ ਵਿੱਚ ਮੈਂ ਹਿੱਸਾ ਲਿਆ ਅਤੇ ਅੱਵਲ ਰਹੀ ਇਸ ਮੁਕਾਬਲੇ ਨੇ ਮੈਨੂੰ ਬੜਾ ਹੀ ਉਤਸ਼ ਉਤਸ਼ਾਹਿਤ ਕੀਤਾ ਅਤੇ ਮੈਂ ਸੋਸ਼ਲ ਮੀਡੀਆ 'ਤੇ ਆਪਣਾ ਚੈਨਲ ਬਣਾਇਆ ਮੈਂ ਆਪਣੇ ਚੈਨਲ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਰੈਸਪੀਆਂ ਸ਼ੇਅਰ ਕਰਦੀ ਰਹਿੰਦੀ ਹਾਂ ਜਿਸ ਨਾਲ ਮੈਨੂੰ ਬੜੀ ਵਾਹੋ ਵਾਹੀ ਮਿਲਦੀ ਹੈ ਅਤੇ ਮੇਰੇ ਖੀਰ ਬਣਾਉਣ ਦੀ ਰੈਸਪੀ ਤਾਂ ਲੋਕਾਂ ਨੇ ਬਹੁਤ ਹੀ ਪਸੰਦ ਕੀਤੀ ਜਿਸ ਨਾਲ ਮੈਨੂੰ ਸਮੇਂ ਸਮੇਂ ਦੇ ਨਾਲ ਹੋਰ ਜ਼ਿਆਦਾ ਵਧੀਆ ਕੰਮ ਕਰਨ ਦਾ ਮੌਕਾ ਮਿਲਦਾ ਰਹਿੰਦਾ ਅਤੇ ਇਸ ਨਾਲ ਮੇਰੀ ਆਪਣੀ ਅੱਡ ਪਹਿਚਾਣ ਬਣ ਗਈ ਅਤੇ ਮੇਰੀ ਆਮਦਨ ਵਿੱਚ ਵੀ ਵਾਧਾ ਹੋਇਆ